ਰਾਜ ਦੇ ਆਲੇ ਦੁਆਲੇ ਜਾਣ ਲਈ ਮਤਲਬ ਅੱਜ ਕੱਲ੍ਹ ਆਵਾਜਾਈ ਦੇ ਤਾਂ ਬਹੁਤ ਸਾਧਨ ਨੇ ਜਿੱਦਾਂ ਆਪਾਂ ਦੇਖੀਏ ਵੀ ਹਰੇਕ ਆਪਾਂ ਜੇ ਕਿਸੇ ਜ ਆਪਣੇ ਰਾਜ ਤੋਂ ਬਾਹਰ ਵੀ ਕਿਤੇ ਜਾਣਾ ਹੋਵੇ ਆਵਾਜਾਈ ਦੇ ਆਪਾਂ ਸਾਧਨਾਂ ਦੀ ਜੇ ਗੱਲ ਕਰੀਏ ਤਾਂ ਮੁੱਖ ਤੌਰ 'ਤੇ ਬੱਸਾਂ ਹੋ ਗਈਆਂ ਬੱਸਾਂ ਤੋਂ ਇਲਾਵਾ ਜੇ ਕਿਤੇ ਦੂਰ ਦੁਰਾਡੇ ਦਾ ਸਫਰ ਹੈ ਤਾਂ ਆਪਣੇ ਟਰੇਨਾਂ ਹੈਗੀਆਂ ਨੇ ਟ੍ਰੇਨ ਹੈ ਨਾ ਰੇਲ ਯਾਤਰਾ ਰੇਲ ਯਾਤਰਾ ਕਰ ਸਕਦੇ ਹਾਂ ਉਸ ਤੋਂ ਇਲਾਵਾ ਜੇ ਆਪਾਂ ਦੇਖੀਏ ਵੀ ਕਿਤੇ ਆਪਾਂ ਬਹੁਤ ਜਿੱਦਾਂ ਬਾਹਰ ਸਫਰ ਕਰਨਾ ਬਾਹਰਲੇ ਦੇਸ਼ਾਂ ਦੀ ਗੱਲ ਕਰੀਏ ਤਾਂ ਉਹਦੇ ਲਈ ਆਪਾਂ ਹਵਾਈ ਸਫਰ ਹੈ ਹੈਗੇ ਆਪਣੇ ਹਵਾਈ ਅੱਡੇ ਹੈਗੇ ਨੇ ਅੱਜ ਕੱਲ੍ਹ ਪੰਜਾਬ ਦੇ ਵਿੱਚ ਆਪਾਂ ਜੇ ਨਜ਼ਦੀਕ ਦੇਖੀਏ ਤਾਂ ਪੰਜਾਬ ਦੇ ਵਿੱਚ ਹੀ ਜਿੱਦਾਂ ਚੰਡੀਗੜ੍ਹ ਹੋ ਗਿਆ ਅੰਬਰਸਰ ਹੋ ਗਿਆ ਅੰਬਰਸਰ ਤੋਂ ਇਲਾਵਾ ਇੱਥੇ ਬਠਿੰਡੇ ਦੇ ਵਿੱਚ ਵੀ ਇੱਕ ਲੋਕਲ ਉਹਦੇ ਆਵਾਜਾਈ ਲਈ ਆਪਣੇ ਹਵਾਈ ਅੱਡੇ ਹੈਗੇ ਨੇ ਉਸ ਤੋਂ ਇਲਾਵਾ ਜਿੱਦਾਂ ਜੇ ਰਾਜ ਦੇ ਆਲੇ ਦੁਆਲੇ ਆਪਾਂ ਸਫਰ ਕਰਨਾ ਨੇੜੇ ਤੇੜੇ ਦੇ ਸ਼ਹਿਰਾਂ ਵਿੱਚ ਤਾਂ ਆਪਣੇ ਬੱਸਾਂ ਹੈਗੀਆਂ ਨੇ ਬੱਸਾਂ ਦੇ ਨਾਲ ਆਪਾਂ ਕਿਤੇ ਵੀ ਜਾ ਜਾ ਸਕਦੇ ਹਾਂ ਮਤਲਬ ਬਹੁਤ ਸਫਰ ਸੁਖਾਲਾ ਹੋ ਗਿਆ ਇਹਨਾਂ ਦੇ ਨਾਲ ਇਹਨਾਂ ਨਾਲ ਆਪਾਂ ਜਾ ਸਕਦੇ ਹਾਂ ਸਫਰ ਆਪਾਂ ਜੇ ਗੱਲ ਕਰੀਏ ਤਾਂ ਕਿਰਾਏ ਦੀ ਤਾਂ ਕਿਰਾਇਆ ਵੀ ਮਤਲਬ ਵੀ ਬਹੁਤ ਘੱਟ ਹੈਗਾ ਜੇ ਆਪਾਂ ਇੱਦਾਂ ਪਬਲਿਕ ਜਿਹੜਾ ਟਰਾਂਸਪੋਰਟ ਆ ਉਹਦੇ ਵਿੱਚ ਆਪਾਂ ਕਰਾ ਬ ਉਹਦੀ ਕਿਰਾਏ ਦੀ ਗੱਲ ਕਰੀਏ ਤਾਂ ਮਤਲਬ ਬਹੁਤ ਸੁਖਾਲਾ ਹੋ ਗਿਆ ਸਫ਼ਰ ਕਰਨਾ ਅੱਜ ਕੱਲ੍ਹ ਦੇ ਦੌਰ ਵਿੱਚ